ਹਾਂ ਮੈਂ ਟੀ ਵੀ ਸ਼ੋਅ ਸ਼ਾਰਕ ਟੈਂਕ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਕਿਉਂਕਿ ਮੈਂ ਰੋਜ਼ਾਨਾ ਹੀ ਸ਼ੋਅ ਦੇਖਦਾ ਹਾਂ ਇਸ ਵਿੱਚ ਵੱਖ ਵੱਖ ਕਿੱਤਿਆਂ ਦੇ ਲੋਕ ਇਸ ਸ਼ੋਅ ਵਿੱਚ ਹੀ ਹਿੱਸਾ ਲੈਂਦੇ ਨੇ ਅਤੇ ਆਪਣੇ ਬਿਜਨਸ ਬਾਰੇ ਕਾਰੋਬਾਰ ਬਾਰੇ ਜੱਜਾਂ ਨੂੰ ਦੱਸਦੇ ਨੇ ਜੱਜ ਹਰੇਕ ਕੈਂਡੀਡੇਟ ਦਾ ਕਾਰੋਬਾਰ ਬਾਰੇ ਸੁਣਦੇ ਨੇ ਅਤੇ ਜੇਕਰ ਉਹਨਾਂ ਦਾ ਕਾਰੋਬਾਰ ਬਿਜ਼ਨਸ ਉਹਨਾਂ ਨੂੰ ਸਹੀ ਲੱਗਦਾ ਹੈ ਤਾਂ ਉਹਨਾਂ ਦੇ ਕਾਰੋਬਾਰ ਵਿੱਚ ਆਪਣਾ ਕੁਛ ਹਿੱਸਾ ਵੀ ਰੱਖਦੇ ਨੇ ਅਤੇ ਨਾਲ ਕਾਰੋਬਾਰ ਨੂੰ ਅੱਗੇ ਵਧਣ ਵਧਾਉਣ ਵਾਸਤੇ ਉਹਨਾਂ ਨੂੰ ਕੁਛ ਪੈਸੇ ਕੁਛ ਲੋਨ ਵੀ ਪ੍ਰੋਵਾਈਡ ਕਰਦੇ ਨੇ ਇਸ ਕਰਕੇ ਸ਼ਾਰਕ ਟੈਂਕ ਜਿਹੜਾ ਹੈ ਇਹ ਕਾਰੋਬਾਰ ਸ਼ੁਰੂ ਕਰਨ ਵਾਸਤੇ ਲੋਕਾਂ ਨੂੰ ਬਹੁਤ ਹੀ ਪ੍ਰਭਾਵਿਤ ਕਰਦਾ ਹੈ ਅਤੇ ਲੋਕਾਂ ਦੀ ਕਾਰੋਬਾਰ ਨੂੰ ਅੱਗੇ ਵਧਾਉਣ ਵਿੱਚ ਬਹੁਤ ਹੀ ਮਦਦ ਕੀਤੀ ਜਾਂਦੀ ਹੈ